ਹੈਲੋ ਹਾਂਜੀ ਸਾਡੇ ਕੋਲੇ ਜਾਨਵਰ ਬਹੁਤ ਜੀ ਬਹੁਤ ਵਧੀਆ ਨਸਲਾਂ ਦੇ ਨ ਸਾਡੇ ਕੋਲੇ ਹਾਥੀ ਸ਼ੇਰ ਚੀਤੇ ਲੰਗੂਰ ਬਾਂਦਰ ਭਾਲੂ ਹਾਂਜੀ ਹਾਂਜੀ ਹਾਥੀ ਵੀ ਨ ਹਾਂਜੀ ਕੋਈ ਗੱਲ ਨੀ ਜੀ ਠੀਕ ਐ ਜੀ

ਹਾਂਜੀ ਹਾਂਜੀ ਹੈਗੀ ਐ ਹਾਂਜੀ ਹਾਂਜੀ ਹੈਗੇ ਐ ਕੋਈ ਨਾ ਆਜਿਓ ਹਾਂਜੀ ਹਾਂਜੀ ਭਾਲੂ ਵੀ ਹੈਗੇ ਐ ਪੰਜ ਚਾਰ ਦੋ ਤਿੰਨ ਕਿਸਮਾਂ ਦੇ ਐ

ਚਿੱਟੇ ਵੀ ਹੈਗੇ ਟਿਕਟ ਤਾਂ ਥੋੜੀ ਹੋਈ ਐ ਐਨੀ ਖਾਸ ਨੀ ਤੁਸੀਂ ਤਾਂ ਦੇਖਣ ਆਉਣਾ ਆਓ ਕੋਈ ਗੱਲ ਨੀ ਬੱਚਿਆਂ ਨੂੰ ਦਿਖਾਓ ਪਿਆਰ ਕਰੋ ਪਤਾ ਲੱਗੇ ਹਾਂਜੀ ਹਾਂਜੀ ਕੋਈ ਗੱਲ ਨੀ ਸਮਾਂ ਸ਼ਾਮ ਦਾ ਹੁੰਦਾ ਜੀ ਤਿੰਨ ਵਜੇ ਤੋਂ ਪੰਜ ਛੇ ਵਜੇ ਤੱਕ ਬਸ

ਉਹ ਜਿਹੜੀ ਉਨ੍ਹਾਂ ਦੀ ਖੁਰਾਕ ਹੁੰਦੀ ਐ ਜੀ ਫੇਰ ਓਹੀ ਦੇਈ ਦੀ ਐ ਹਾਂਜੀ ਹਾਂ ਥੋਨੂੰ ਪਤਾ ਈ ਐ ਬਾਂਦਰ ਲੰਗੂਰ ਤਾਂ ਕੇਲੇ ਖਾ ਕੇ ਖੁਸ਼ ਐ ਉਹ ਲੈ ਆਇਓ ਉਨ੍ਹਾਂ ਵਾਸਤੇ ਕੇਲੇ ਹਾਂ ਜੀ ਕੋਈ ਨਾ ਜੀ ਹੋਰ ਮੋਕੀ ਖਾਂਦਾ ਐਗਾ ਕੇਲੇ ਖਾਂਦਾ ਐ ਲੰਗੂਰ ਕੇਲੇ ਖਾਂਦਾ ਐ ਹਾਂ ਜੋ ਸ਼ੇਰ ਨੂੰ ਤਾਂ ਬਸ ਮਾੜਾ ਮੋਟਾ ਓਧਰੋਂ ਮਾਸ ਮਿੱਟੀ ਜੀ ਲੈ ਆਉਂਦੇ ਅਨ ਦੇ ਜਾਂਦੇ ਐ ਜੀ ਬਾਹਰੋਂ ਆਉਂਦੇ ਜੀ ਪੈਸੇ ਪੂਸੇ ਦੇ ਜਾਂਦੇ ਅਨ ਉਹ ਅਸੀਂ ਲਿਆ ਕੇ ਫੇਰ ਉਨ੍ਹਾਂ ਨੂੰ ਖਰਾਕ ਦੇ ਦਈ ਦੀ ਆ

ਹਾਂਜੀ ਹਾਂਜੀ ਉਹ ਹੈਗੀਆਂ ਪੰਜ ਸੱਤ ਕ ਹਾਂ ਹਾਂਜੀ ਹਾਂਜੀ ਹੈਗੇ ਨੇ ਹਿਰਨ ਵੀ ਹੈਗੇ ਆ ਬਾਰਾਸਿੰਗੇ ਵੀ ਹੈਗੇ ਐ ਸਿੰਗਾਂ ਵਾਲੇ ਵੱਡੇ ਵੱਡੇ ਸਿੰਗਾਂ ਵਾਲੇ ਉਹ ਹੈਗੇ ਜੋੜਾ ਜੋੜਾ ਜੀ ਜੋੜਾ ਜੋੜਾ ਐ

ਅੱਛਾ ਜੀ ਠੀਕ ਐ ਜੀ ਅੱਛਾ ਓਕੇ ਜੀ